ਹੈਲੋ ਹਾਂਜੀ ਤੁਸੀਂ ਕੌਣ ਓਕੇ ਹਾਂਜੀ ਦੇਖੋ ਜੀ ਹੁਣ ਮੀਤ ਅਤੇ ਗੁਰਪ੍ਰੀਤ ਦੋਨੋਂ ਬੈਸਟ ਫਰੈਂਡਸ ਨੇ ਅਤੇ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਦੋਨੋਂ ਕਿਤੇ ਵਧੀਆ ਸਕੂਲ ਦੇ ਵਿੱਚ ਇਕੱਠੇ ਪੈ ਜਾਣ ਅਤੇ ਗੁਰਪ੍ਰੀਤ ਨੇ ਤਾਂ ਮੈਡੀਕਲ ਲੈਣ ਬਾਰੇ ਸੋਚਿਆ ਏ ਓਕੇ ਸਰ ਮੇਰੇ ਕੁਝ ਰੈਲੇਟਿਵਜ਼ ਵੀ ਨੇ ਉਹ ਵੀ ਉਹਨਾਂ ਦੇ ਵੀ ਬੱਚਿਆਂ ਨੇ ਮਾਈ ਭਾਗੋ ਤੋਂ ਹੀ ਕੀਤੀ ਹੈ ਅਤੇ ਮੈਂ ਉੱਥੋਂ ਦਾ ਸੋਚ ਰਹੀ ਹਾਂ ਹਾਂਜੀ

ਹਾਂਜੀ ਸਰ ਮੈਂ ਵੀ ਇਹੀ ਚਾਹੁੰਦੀ ਹਾਂ ਸਰ ਵੈਸੇ ਜੇ ਦੇਖਿਆ ਜਾਵੇ ਤਾਂ ਤਰਨ ਤਾਰਨ ਦੇ ਵਿੱਚ ਹੋਰ ਕੋਈ ਇੰਨਾਂ ਵਧੀਆ ਸਕੂਲ ਹੈ ਵੀ ਨਹੀਂ ਤਾਂ ਮਾਈ ਭਾਗੋ ਹੀ ਬੈਸਟ ਰਹੇਗਾ ਹਾਂਜੀ ਸਰ ਫਿਰ ਇੱਧਰ ਹੀ ਮਿਲ ਲਾਂਗੇ ਹਾਂਜੀ ਓਕੇ ਜੀ